ਬੋਲ ਰਹੇ ਮੈਂ ਨਾ ਹਰਚਿਤ ਬੋਲਦਾ ਪਿਆ ਵਾਂ ਸਰ ਮੇਰੇ ਨਾ ਮਤਲਬ ਮੈਨੂੰ ਨਾ ਥੋੜ੍ਹਾ ਡਾਇਟ 'ਚ ਇਸ਼ੂ ਆ ਰਿਹਾ ਮੈਨੂੰ ਨਾ ਮਤਲਬ ਲੂਸ ਮੋਸ਼ਨਸ ਲੱਗੇ ਹੋਏ ਆ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਉਹਨਾਂ ਨੂੰ ਰੋਕਣ ਵਾਸਤੇ ਤੁਸੀਂ ਕੁਝ ਦੱਸ ਸਕਦੇ ਹੋ ਓਕੇ ਓਕੇ ਸਰ ਪਾਣੀ ਤੋਂ ਓਕੇ ਅਤੇ ਹਾਂਜੀ ਅਤੇ ਹੋਰ ਹੋਰ ਕੁਛ ਦਵਾਈ ਦਬੁਈ ਨਹੀਂ ਹੋ ਸਕਦੀ ਕਿਉਂਕਿ ਜ਼ਿਆਦਾ ਲੈਵਲ 'ਤੇ ਹੋ ਰਿਹਾ ਐਕਸਟ੍ਰੀਮ ਲੈਵਲ 'ਤੇ ਹੋ ਰਿਹਾ ਓਕੇ